ਹੈਲੋ ਹੈਲੋ ਹਾਂਜੀ ਹਾਂਜੀ ਅੱਛਾ ਜੀ ਠੀਕ ਹੈ ਕਿਸ ਤਰ੍ਹਾਂ ਦਾ ਮਕਾਨ ਚਾਹੀਦਾ ਕਿੰਨੇ ਸਾਈਜ਼ ਵਿੱਚ ਹੋਏ ਅੱਛਾ ਜੀ ਅਤੇ ਕਿਸ ਤਰ੍ਹਾਂ ਦੀ ਕਲੋਨੀ ਅਤੇ ਕਿਤਨਾ ਕਿੰਨਾ ਕੁ ਰੈਂਟ ਤੁਸੀਂ ਪੇ ਕਰਨਾ ਚਾਹੁੰਦੇ ਹੋ ਅੱਛਾ ਅਤੇ ਕੀ ਰਿਕੁਾਇਰਮੈਂਟ ਹੈ ਤੁਹਾਡੀ ਮਕਾਨ ਬਾਰੇ ਕਿਸ ਤਰ੍ਹਾਂ ਦਾ ਇਲਾਕਾ ਹੋਵੇ ਏਰੀਆ ਵਾਈਜ਼ ਠੀਕ ਹੈ ਅਤੇ ਉੱਪਰ ਨੀਚੇ ਅਗਰ ਕੋਈ ਵਿੱਚ ਹੋਰ ਰਹਿੰਦਾ ਹੋਏ ਤਾਂ ਫਿਰ ਕੋਈ ਪ੍ਰੋਬਲਮ ਤਾਂ ਨਹੀਂ ਕਿੰਨਾ ਕੁ ਤੁਸੀਂ ਪੇ ਕਰਨਾ ਚਾਹੁੰਦੇ ਹੋ ਹਮ ਥੋੜ੍ਹਾ ਜਿਹਾ ਦੇਖਣਾ ਪਵੇਗਾ ਠੀਕ ਹੈ ਕਿੰਨੀ ਕੁ ਤੁਸੀਂ ਹਾਂਜੀ ਕਿੰਨਾ ਉਹਦਾ ਬਿੱਲ ਵਗੈਰਾ ਦਾ ਅਤੇ ਪਾਣੀ ਦਾ ਉਹਨਾਂ ਦਾ ਸਿਸਟਮ ਅਲੱਗ ਅਲੱਗ ਰਹੇਗਾ ਤੁਹਾਨੂੰ ਉਹ ਅਲੱਗ ਪੇ ਕਰਨਾ ਪਵੇਗਾ

ਚਲੋ ਮੈਂ ਦੇਖਦੀ ਹਾਂ ਜਿੰਨਾ ਜਲਦੀ ਹੁੰਦਾ ਮੈਂ ਤੁਹਾਨੂੰ ਦੁਬਾਰਾ ਕਾਲ ਕਰਾਂਗੀ ਥੈਂਕ ਯੂ